ਹੈਲੋ ਮੈਮ ਹੈਲੋ ਹੈਲੋ ਹਾਂਜੀ ਮੈਮ ਕਿਵੇਂ ਠੀਕ ਓਂ ਹਾਂਜੀ ਠੀਕ ਹਾਂਜੀ ਹਾਂਜੀ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਠਾਕ ਵਧੀਆ ਜੀ ਅੱਛਾ ਜੀ ਓਕੇ ਅੱਛਾ ਓਕੇ ਜੀ ਹਾਂਜੀ ਹਾਂਜੀ ਹਾਂਜੀ ਇੱਥੇ ਦੇਖੋ ਤੁਸੀਂ ਇੱਕ ਸਿੱਧੂ ਮੂਸੇਆਲਾ ਹੈਗਾ ਕੋਠੀ ਹੈਗੀ ਵਧੀਆ ਘੁੰਮਣ ਵਾਸਤੇ ਹਾਂਜੀ ਇੱਕ ਪਾਰਕ ਵਗੈਰਾ ਵਧੀਆ ਹੈਗਾ ਅਤੇ ਇੱਕ ਚੀਜ਼ ਵਧੀਆ ਬਣੀ ਹੋਈ ਹੈ ਘੁੰਮਣ ਵਾਸਤੇ ਮੋਲ ਵਗੈਰਾ ਬਣੇ ਹੋਏ ਸਕਾਈ ਮੋਲ ਹੈਗਾ ਸਾਰਾ ਕੁਛ ਹੈਗਾ ਜੀ ਹਾਂਜੀ ਹੋਰ ਪਾਰਕ ਵਗੈਰਾ ਹੈਗੇ ਹੈ ਜੀ ਹਾਂਜੀ ਹਾਂਜੀ ਸਿੱਧੂ ਮੂਸੇਵਾਲੇ ਦੀ ਕੋਠੀ ਹੈਗੀ ਸਿੰਗਰ ਦੀ ਵਧੀਆ ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਜੀ ਨਹੀਂ ਜੀ ਐਂਟਰੀ ਟਿਕਟ ਨਹੀਂ ਹੈਗੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਹਾਂ ਸਿੰਗਰ ਓ ਅੱਜ ਹਾਂ ਜੀ ਹਾਂਜੀ ਹਾਂਜੀ ਸਿੰਗਰ ਹਾਂ ਪਤਾ ਹਾਂ ਰਿਹਾ ਨਹੀਂ ਉਹ ਹੁਣ ਤਾਂ ਪਰ ਉਨਦਾ ਉੱਦਾ ਤਾਂ ਵਧੀਆ ਸਿੰਗਰ ਸੀ ਉਹ ਹਾਂ ਉਹ ਸਿੰਗਰ ਬਹੁਤ ਵਧੀਆ ਸੀ ਅਤੇ ਹੋਰ ਬਸ ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬੱਚਿਆਂ ਦੀ ਨੌਲੇਜ ਵਧੇਗੀ ਹਾਂਜੀ ਹਾਂਜੀ ਹਮ ਹਮ ਹਾਂਜੀ ਹੋਰ ਵੀ ਬਹੁਤ ਵਧੀਆ ਸਿੰਗਰ ਹੈਗੇ ਜੀ ਓਹ ਆਉਂਦੇ ਸੀ ਉਹਨਾਂ ਕੋਲ ਜਾਂ ਮਿਲਦੇ ਕਰਦੇ ਸੀ ਆਪਸ 'ਚ ਬਹਿੰਦੇ ਸੀ ਹਾਂਜੀ ਹੋਰ ਜੀ ਠੀਕ ਓਕੇ ਜੀ